ਪੰਜਾਬ ਵਿੱਚ ਕਈ ਪ੍ਰਮੁੱਖ ਆਰਟ ਗੈਲਰੀਆਂ ਅਤੇ ਅਜਾਇਬ ਘਰ ਹਨ ਜਿਵੇਂ ਕਿ ਦਰਬਾਰ ਸਾਹਿਬ ਵਿੱਚ ਇੱਕ ਅਜਾਇਬ ਘਰ ਹੈ ਜਿਸ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਤਸਵੀਰਾਂ ਹਨ ਅਤੇ ਗੁਰੂ ਸਾਹਿਬਾਨ ਦੇ ਤਲਵਾਰਾਂ ਅਤੇ ਸ਼ ਤੀਰ ਸ਼ਸਤਰ ਆਦਿ ਹਨ ਅਤੇ ਹੱਥ ਲਿਖਤ ਗੁਟਕੇ ਸਾਹਿਬ ਵੀ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦੀਆਂ ਸਿੱਕੇ ਵੀ ਮੌਜੂਦ ਹਨ ਅਤੇ ਪੁਰਾਣੇ ਵੇਲੇ ਦੀਆਂ ਤੋਪਾਂ ਦੀਆਂ ਗੋਲੀਆਂ ਅਤੇ ਪੁਰਾਣੇ ਵੇਲੇ ਦੀਆਂ ਬੰਦੂਕਾਂ ਵੀ ਹਨ ਅਤੇ ਦਰਬਾਰ ਸਾਹਿਬ ਦੇ ਹੇਠਾਂ ਘੰਟਾ ਘਰ ਵਾਲੇ ਪਾਸੇ ਇੱਕ ਪਾ ਹੋਰ ਮਿਊਜ਼ੀਅਮ ਹੈ ਜਿਸ ਵਿੱਚ ਗੁਰਬਾਣੀ ਨਾਲ ਸੰਬੰਧਿਤ ਵੀਡੀਓ ਦਿਖਾਈ ਜਾਂਦੀ ਹੈ ਹਰ ਕਮਰੇ ਵਿੱਚ ਵੱਖ ਵੱਖ ਵੀਡੀਓ ਹਨ ਜੋ ਕਿ ਸਿੱਖ ਇਤਿਹਾਸ ਨਾਲ ਸੰਬੰਧਿਤ ਹਨ ਅਤੇ ਇੱਕ ਹੋਰ ਮਿਊਜ਼ੀਅਮ ਹੈ ਜਿਹੜਾ ਕਿ ਕਤਵਾਲੀ ਪਾ ਵਾਲੇ ਪਾਸੇ ਹੈ ਪਾਰਟੀਸ਼ੀਅਨ ਮਿਊਜ਼ੀਅਮ ਉਸ ਦੀ ਟਿਕਟ ਦਸ ਰੁਪਏ ਹੈ ਅਤੇ ਉਹ ਸਵੇਰੇ ਦਸ ਵਜੇ ਤੋਂ ਪੰਜ ਵਜੇ ਤੱਕ ਖੁੱਲ੍ਹਾ ਹੁੰਦਾ ਹੈ ਉਸ ਵਿੱਚ ਉੱਨੀ ਸੌ ਸੰਤਾਲੀ ਦੇ ਵੇਲੇ ਦੀਆਂ ਇਤਿਹਾਸਿਕ ਗੱਲਾਂ ਹਨ ਉਸ ਵਿੱਚ ਕਈ ਸ਼ਹੀਦਾਂ ਦੀਆਂ ਤਸਵੀਰਾਂ ਹਨ ਅਤੇ ਕੁਝ ਵੀਡੀਓ ਵੀ ਹੈ ਅਤੇ ਉਸ ਵਿੱਚ ਪੁਰਾਣੇ ਵੇਲੇ ਦੀਆਂ ਪੁਸ਼ਾਕਾਂ ਵੀ ਹਨ ਅਤੇ ਕੁਝ ਸਮਾਨ ਹਨ ਜੋ ਕਿ ਪੁਰਾਣੇ ਸਮੇਂ ਦਾ ਹੈ